ਮੈਨੂੰ ਤਾਂ ਕੋਈ ਮੁਸ਼ਕਿਲ ਨਹੀਂ ਆਈ ਵਕੀਲ ਪੁਲਿਸ ਪੰਚਾਇਤ ਦੇ ਵਿੱਚ ਬਟ ਮੇਰੀ ਫੈਮਿਲੀ ਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆਈ ਸਾਡੀ ਜਿਹੜੀ ਜਮੀਨ ਸੀਗੀ ਉਹ ਜਿਹੜੇ ਹੈਗੇ ਹੈਗੇ ਕੋਈ ਧੱਕੇ ਨਾਲ ਸਾਡੇ ਤੋਂ ਨੱਪਣ ਨੂੰ ਫਿਰਦੇ ਸੀਗੇ ਕੋਈ ਉਸ 'ਤੇ ਕਬਜ਼ਾ ਕਰਨ ਨੂੰ ਫਿਰਦੇ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਐਗੇ ਪਰੂਫ ਜਿਹੜੇ ਹੈਗੇ ਐਗੇ ਫੇਕ ਬਣਾ ਚੱਕੇ ਸੀਗੀ ਜਦੋਂ ਮੈਂ ਉਹਨਾਂ ਦਾ ਕੇਸ ਫਾਈਲ ਕੀਤਾ ਤਾਂ ਉਹਨਾਂ ਨੇ ਉੱਥੇ ਵੀ ਆਪਣਾ ਜਿਹੜਾ ਹੈਗਾ ਦਬਾਅ ਪਾਇਆ ਅਤੇ ਉਹਨਾਂ ਨੂੰ ਰਿਸ਼ਵਤ ਦੇ ਕੇ ਜਿਹੜਾ ਹੈਗਾ ਐਗਾ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਬਟ ਮੈਂ ਵੀ ਹਾਰ ਨਹੀਂ ਮੰਨੀ ਮੈਂ ਆਪਣੇ ਆਪ 'ਤੇ ਵਿਸ਼ਵਾਸ ਰੱਖਿਆ ਅਤੇ ਮੈਂ ਆਪਣੇ ਜਿਹੜੇ ਹੈਗੇ ਆਗੇ ਡਿਸਟ੍ਰਿਕਟ ਦੇ ਕਮਿਸ਼ਨਰ ਕੋਲ ਡੀ ਸੀ ਕੋਲ ਜਿਹੜੇ ਹੈਗੇ ਐਗੇ ਮੈਂ ਉਹਨਾਂ ਨੂੰ ਲੈਟਰ ਦਿੱਤਾ ਆਪਣੀ ਜਿਹੜੀ ਹੈਗੀ ਐਗੀ ਆਪਣੀ ਜਿਹੜੀ ਪੂਰੀ ਅਪੀਲ ਕੀਤੀ ਆਪਣੀ ਜਿਹੜੀ ਹੈਗੀ ਐਗੀ ਪੂਰੀ ਜਿਹੜੀ ਹੈਗੀ ਐਗੀ ਕੇਸ ਫਾਈਲ ਕੀਤਾ ਉਹਨਾਂ ਨੂੰ ਆਪਣੀ ਸਾਰੀ ਗੱਲ ਦੱਸੀ ਅਤੇ ਉਹਨਾਂ ਨੇ ਮੇਰੀ ਪੂਰੀ ਹੈਲਪ ਕੀਤੀ ਅਤੇ ਉਹਨਾਂ ਨੇ ਮੈਨੂੰ ਕੇਸ ਜਿਤਾਇਆ ਅਤੇ ਮੈਂ ਇਹ ਕੇਸ ਜਿੱਤਿਆ ਅਤੇ ਮੈਂ ਇਸ ਭ੍ਰਿਸ਼ਟਾਚਾਰ ਤੋਂ ਵੀ ਮੈਨੂੰ ਬਹੁਤ ਜਾਦ ਮੈਨੂੰ ਨਹੀਂ ਮੇਰੀ ਫੈਮਿਲੀ ਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਵੀ ਇਸ ਤਰ੍ਹਾਂ ਫੀਲ ਹੋਇਆ ਵੀ ਇਸ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈਗਾ ਐਗਾ ਜਿਹੜੇ ਲੋਕ ਇਹਨਾਂ ਬਾਰੇ ਘੱਟ ਅਵੇਅਰ ਹੈਗੇ ਆ ਉਹ ਇਸ ਭ੍ਰਿਸ਼ਟਾਚਾਰ ਦੇ ਵਿੱਚ ਬਹੁਤ ਆ ਰਹੇ ਹੈਗੇ ਆ ਇਹ ਜਿਹੜਾ ਹੈਗਾ ਭ੍ਰਿਸ਼ਟਾਚਾਰ ਬੰਦ ਹੋਣਾ ਚਾਹੀਦਾ ਅਤੇ ਲੋਕਾਂ ਨੂੰ ਜਿਹੜੀ ਹੈਗੀ ਹੈ ਅਵੇਰਨੈਸ ਹੋਣੀ ਚਾਹੀਦੀ ਹੈ ਵੀ ਇਸ ਤਰ੍ਹਾਂ ਕੀ ਕਰਨਾ ਚਾਹੀਦਾ ਹੈਗਾ ਐਗਾ ਸੋ ਮੇਰਾ ਤਾਂ ਜਿਹੜਾ ਸੀਗਾ ਮੇਰੀ ਫੈਮਿਲੀ ਦਾ ਜਿਹੜਾ ਕੇਸ ਸੀਗਾ ਉਹ ਸੋਲਵ ਹੋ ਗਿਆ ਅਤੇ ਅਸੀਂ ਜਿਹੜਾ ਹੈਗਾ ਕੇਸ ਜਿੱਤ ਲਿਆ ਅਤੇ ਜਿਹੜੀ ਹੈਗੀ ਐਗੀ ਮੇਰੀ ਸਾਡੀ ਜਮੀਨ ਜਿਹੜੀ ਹੈਗੀ ਐਗੀ ਸਾਨੂੰ ਵਾਪਸ ਮਿਲ ਗਈ ਅਤੇ ਅਸੀਂ ਇਸ ਗੱਲ ਤੋਂ ਵੀ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਜਿਹੜੇ ਕਮਿਸ਼ਨਰ ਨੇ ਸਾਡੀ ਲੈਟਰ ਅਸੀਂ ਉਹਨਾਂ ਨੂੰ ਦਿੱਤੀ ਸੀਗੀ ਉਹਨਾਂ ਨੇ ਉਸ 'ਤੇ ਕਾਰਵਾਈ ਕੀਤੀ ਅਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਸੋ ਉਹ ਸਾਨੂੰ ਇਹ ਜਿਹੜਾ ਭ੍ਰਿਸ਼ਟਾਚਾਰ ਹੈਗਾ ਗਾ ਜਿਹੜਾ ਹੋਇਆ ਉਹ ਪਸੰਦ ਨਹੀਂ ਆਇਆ ਅਤੇ ਇਹ ਜਿਹੜਾ ਹੈਗਾ ਭ੍ਰਿਸ਼ਟਾਚਾਰ ਹੈਗਾ ਇਸ 'ਤੇ ਰੋਕ ਪੈਣੀ ਚਾਹੀਦੀ ਹੈ ਇਹ ਰੁਕਣਾ ਹੋਣਾ ਚਾਹੀਦਾ ਕਿਉਂਕਿ ਕਿਸੇ ਗਰੀਬ ਦੇ ਨਾਲ ਜਿਹੜਾ ਹੈਗਾ ਐਗਾ ਅਨਿਆਏ ਹੋ ਰਿਹਾ ਹੈਗਾ ਸੋ